ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਅਸੀਂ ਨਾ ਸਾਡੇ ਨਾ ਅਸੀਂ ਔਡਰ ਦੇਣਾ ਸੀ ਲੋਹੜੀ ਦੇ ਸਪੈਸ਼ਲ ਪ੍ਰੋਗਰਾਮ ਤੇ ਉਹ ਬਣਵਾਣਾ ਸੀ ਤਿਲ ਬੁਗਾ ਤੇ ਖਜੂਰ ਬਣਵਾਉਨੇ ਸੀ ਸਾਡੇ ਨਹੀਂ ਸਾਡੇ ਨਾ ਪੋਤਾ ਹੋਇਆ ਕਾਫੀ ਸਾਲ ਬਾਅਦ ਹੋਇਆ ਤੇ ਅਸੀਂ ਨਾ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਘਰੇ ਰਿਸ਼ਤੇਦਾਰਾਂ ਨੂੰ ਇਨਵਾਈਟ ਕੀਤਾ ਹੋਇਆ ਤੇ ਸੁਪਨੇ ਤੁਸੀਂ ਕਾਫੀ ਸਾਲ ਪਹਿਲਾਂ ਤੇ ਜਾ ਕੇ ਹੁਣ ਪੂਰੇ ਹੋਏ ਸਾਡੇ ਸੁਪਨਾ ਤੇ ਅਸੀਂ ਰਿਸ਼ਤੇਦਾਰ ਨੂੰ ਬੁਲਾਇਆ ਗੁਆਂਢ ਨੂੰ ਵੀ ਬੁਲਾਇਆ ਹੋਇਆ ਤੇ ਸਾਨੂੰ ਨਾ ਪੰਜ ਕਿਲੋ ਖਜੂਰ ਤੇ ਉਹ ਬਿੱਲ ਬੁੱਗਾ ਬਣਵਾਣਾ ਸੀ ਪੰਜ ਕਿਲੋ ਵੀ ਬਣਾ ਦੇ ਹਾਂ ਆਹ ਵਾਸਤੇ ਲੋਹੜੀ ਤੇ ਸਪੈਸ਼ਲ ਹੁੰਦਾ ਨਾ ਇਸ ਕਰਕੇ ਤੇ ਅਸੀਂ ਸਾਨੂੰ ਤੇਈ ਅਲੱਗ ਅਲੱਗ ਤਰਾਂ ਡੱਬੇ ਵੀ ਬਣਾਏ ਤੁਸੀਂ ਉਹ ਵੀ ਸਾਨੂੰ ਬਣਾਇਆ ਅਤੇ ਮੁੰਡੇ ਦਾ ਨਾਮ ਵੀ ਲਿਖਵਾਣਾ ਅਸੀਂ ਜਰਾ ਕਰਦੇ ਆ ਜੇ ਤੇ ਤੁਸੀਂ ਬਣਾ ਸਕ ਬਣਾ ਦੋਗੇ ਠੀਕ ਹ ਅਸੀਂ ਤੁਹਾਡੀ ਦੁਕਾਨ ਦਾ ਬਹੁਤ ਨਾਮ ਸੁਣਿਆ ਵੀ ਬਹੁਤ ਵਧੀਆ ਬਿਨਾਂ ਮਿਲਾਵਟ ਤੋਂ ਬਲਾ ਬਣਾਉਂਦੇ ਹੋ ਮਿਠਾਈ ਤੇ ਤੁਹਾਡੀ ਬਹੁਤ ਵਧੀਆ ਤਾਜ਼ੀ ਮਿਠਾਈ ਹੁੰਦੀ ਤੇ ਸਪੈਸ਼ਲ ਹੁੰਦੀ ਆ ਜੇ ਤੁਸੀਂ ਆਨਲਾਈਨ ਵਧੀਆ ਬਣਾਓਗੇ ਤਾਂ ਸਾਡੇ ਰਿਸ਼ਤੇਦਾਰ ਮੰਨ ਲਓ ਅਸੀਂ ਕਿਸੇ ਵਿਆਹ ਸ਼ਾਦੀ ਕਿਸੇ ਹੋਰ ਨੇ ਸਾਡੇ ਰਿਸ਼ਤੇਦਾਰਾਂ ਨੇ ਬਣਵਾਉਣੀ ਹੋਏ ਤੇ ਤੁਹਾਡੀਆਂ ਅਸੀਂ ਤੁਹਾਡੀ ਦੁਕਾਨ ਤੋਂ ਹੀ ਲੈ ਜਿਆ ਕਰਾਂਗੇ ਤੇ ਠੀਕ ਆ ਹਾਂ ਮੈਂ ਸੁਣਿਆ ਤੁਸੀਂ ਵੀ ਕਰਦੇ ਹੋਣਗੇ ਠੀਕ ਹੈ ਤਾਂ ਕੋਈ ਨਹੀਂ ਤੁਸੀਂ ਬਹੁਤ ਵਧੀਆ ਬਣਾਉਂਦੇ ਆ ਨਾ ਅਸੀਂ ਵੀ ਰਿਸ਼ਤੇਦਾਰਾਂ ਨੂੰ ਤੁਹਾਡੇ ਕੋਲ ਲੈ ਕੇ ਜਾਇਆ ਕਰਾਂਗੇ ਮੈਂ ਮਿਠਾਈ ਤੁਹਾਨੂੰ ਹਾਂਜੀ ਠੀਕ ਹੈ ਤੇ ਤੁਸੀਂ ਮੰਨ ਲਓ ਜੇ ਔਰ ਕੇਟਰਿੰਗ ਤੁਸੀਂ ਲੈ ਲੈਲਾ ਜੇ ਸਾਡੇ ਫਿਰ ਉਹੀ ਵਿਆਹ ਦੇ ਮੰਨ ਲਓ ਲੋ ਓ ਉਣੱਤੀ ਤਰੀਕ ਨੂੰ ਵਿਆਹ ਹੈਗਾ ਤੇ ਤੁਸੀਂ ਕੇਟਰਿੰਗ ਜੀ ਲੈ ਲਿਓ ਜੇ ਸਾਡੇ ਵਿਆਹ ਦੀ ਸਮਾਨ ਬਣਾ ਕੇ ਦੇ ਦਿਆ ਜੇ ਹਾਂਜੀ ਤੁਸੀਂ ਸਾਨੂੰ ਲੱਡੂ ਵੀ ਬਣਾ ਦਿਆਂਗੇ ਤੁਹਾਨੂੰ ਲੱਡੂ ਬਹੁਤ ਮਸ਼ਹੂਰ ਹੈਗੇ ਤੁਹਾਡੀ ਦੁਕਾਨ ਦੇ ਮੋਤੀ ਚੂਰ ਦੇ ਲੱਡੂ ਹਾਂ ਤੇ ਉਹ ਵੀ ਸਾਨੂੰ ਚਾਹੀਦੇ ਨੇ ਵੀਹ ਕੁ ਡੱਬੇ ਬਣਵਾ ਦਿਆ ਜੇ ਤੇ ਹੋਰ ਤੁਹਾਡੀ ਦੁਕਾਨ ਤੇ ਕੀ ਮਸ਼ਹੂਰ ਹੈਗਾ ਸਾਨੂੰ ਦੱਸਿਆ ਜੇ ਵੀ ਹੋਰ ਵੀ ਕੁਛ ਬਣਦਾ ਹੋਏ ਤੁਹਾਡੀ ਦੁਕਾਨ ਤੇ

ਅੱਛਾ ਤੁਸੀਂ ਆਪਦੀ ਦੁਕਾਨ ਤੇ ਦੁੱਧ ਵਗੈਰਾ ਵੀ ਰੱਖਿਆ ਹੀ ਹੋਣਾ ਹਾਂ ਥਾਡਾ ਦੁੱਧ ਵੀ ਬਹੁਤ ਵਧੀਆ ਹੈਗਾ ਕੋਈ ਨਹੀਂ ਅਸੀਂ ਉਹ ਵੀ ਲੈ ਲਾਂਗੇ ਤੁਹਾਡੇ ਕੋਲ ਤੇ ਕੇਟਰਿੰਗ ਤੇ ਜੇ ਮੰਨ ਲੋ ਅਸੀਂ ਥੋਡੇ ਤੋ ਕੇਟਰਿੰਗ ਕਰਾਣੀ ਤੁਸੀਂ ਸਾਨੂੰ ਸਾਡੇ ਕੋਲ ਕਿੰਨੇ ਪੈਸੇ ਲੇ ਲਉਗੇ ਹਾਂ ਸਾਡੇ ਜਿਹੜੇ ਉਹ ਉਣੱਤੀ ਤਰੀਕ ਦੀ ਜਿਹੜੀ ਮੁੰਡੇ ਦਾ ਵਿਆਹ ਨਾ ਅਸੀਂ ਬਰਾਤ ਲੈ ਕੇ ਜਾਂਦੇ ਆ ਤੇ ਪਿੰਡਾਂ ਤੋਂ ਚੀਜ਼ ਸਾਨੂੰ ਦੱਸਦੇ ਆ ਨਾ ਢਾਈ ਸੋ ਬੰਦੇ ਦਾ ਖਾਣਾ ਬਈ ਮਿਠਾਈ ਵਗੈਰਾ ਬਣਾਣੀ ਐ ਤੇ ਤੇ ਬਣਾ ਪਹਿਲਾਂ ਰੇਟ ਦੱਸ ਦਿਓ ਜੀ ਕਿੰਨੇ ਪੈਸੇ ਹਾਂ ਤੇ ਹਾਂ ਵੈਸ਼ ਨਹੀਂ ਕੰਮ ਕਰਨਾ ਤੇ ਸਾਡੇ ਨਾ ਵੈਸ਼ਨੂੰ ਨੇ ਸਾਰੇ ਤੇ ਵੈਸ਼ਨੂੰ ਤੁਸੀਂ ਕੰਮ ਕਰਿਆ ਜੇ ਠੀਕ ਹੈ

ਹਾਂਜੀ ਜੀ ਸ਼ਾਮ ਨੂੰ ਠੀਕ ਤੁਸੀਂ ਪਹੁੰਚਾ ਦਿਆ ਤੇ ਸਾਨੂੰ ਐਡਵਾਂਸ ਵੀ ਦੱਸਦਿਆ ਜੇ ਅਸੀਂ ਤੁਹਾਨੂੰ ਦੇ ਦਾਂਗੇ ਠੀਕ ਐ ਜੀ ਓਕੇ ਧੰਨਵਾਦ ਜੀ